ਇੱਕ ਖੂਹ ਤੋਂ ਪਾਣੀ ਇਲੈਕਟਰਿਕ ਮੋਟਰ ਦੀ ਵਰਤੋਂ ਕਰਨ ਦਾ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ ਮੋਟਰ ਮੋਟਰ ਦੀ ਵਰਤੋਂ ਕਰਨ ਲਈ ਸਾਨੂੰ ਖੂਹ ਦੀ ਗਹਿਰਾਈ ਅਤੇ ਪਾਣੀ ਦੀ ਮਾਤਰਾ ਮਿਣਨੀ ਪਵੇਗੀ ਫਿਰ ਉਸ ਨਾਲ ਪੰਪ ਅਤੇ ਪਾਈਪਲਾਈਨ ਨੂੰ ਜੋੜਾਂਗੇ ਪਾਣੀ ਕੱਢਣ ਵਾਲੀ ਮਸ਼ੀਨ ਵਿੱਚ ਸੁਰੱਖਿਆ ਜ਼ਰੂਰੀ ਹੈ ਮੋਟਰ ਨੂੰ ਓਵਰਹੀਟ ਨਹੀਂ ਹੋਣ ਦੇਣਾ ਇਸ ਲਈ ਸਾਨੂੰ ਫਿਊਜ਼ ਦੀ ਵਰਤੋਂ ਕਰਨੀ ਚਾਹੀਦੀ ਹੈ ਲੋਡ ਵਧਣ ਅਤੇ ਘਟਣ ਦਾ ਵੀ ਧਿਆਨ ਰੱਖਣਾ ਪਵੇਗਾ ਇਸ ਲਈ ਸਾਨੂੰ ਵਿਧਿਉਤ ਸਪਲਾਈ ਦੀ ਜ਼ਰੂਰਤ ਹੁੰਦੀ ਹੈ ਜੇ ਵਿਧਿਉਤ ਸਪਲਾਈ ਵਧੇ ਜਾਂ ਘਟੇ ਤਾਂ ਸਵਿਚ ਬੰਦ ਹੋ ਜਾਏ ਇਸ ਲਈ ਸਾਨੂੰ ਇਸ ਤਰ੍ਹਾਂ ਦਾ ਪਾਵਰ ਪਲੱਗ ਦੀ ਵਰਤੋਂ ਕਰਨੀ ਪਵੇਗੀ ਆਟੋਮੈਟਿਕ ਸਿਸਟਮ ਸ਼ਾਮਿਲ ਕੀਤਾ ਜਾ ਸਕਦਾ ਹੈ ਜੋ ਪਾਣੀ ਦੇ ਸਤਰ ਨੂੰ ਮਾਪਦਾ ਹੈ ਅਤੇ ਮੋਤਕ ਮੋਟਰ ਨੂੰ ਬੰਦ ਜਾਂ ਚਾਲੂ ਕਰਦਾ ਹੈ ਇਸ ਤਰ੍ਹਾਂ ਇੱਕ ਪ੍ਰਭਾਵਸ਼ਾਲੀ ਖੂਹ ਵਿੱਚੋਂ ਪਾਣੀ ਖਿੱਚਣ ਦਾ ਸਿਸਟਮ ਤਿਆਰ ਹੋ ਸਕਦਾ ਹੈ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਹੋਵੇਗਾ ਜਿਸ ਨਾਲ ਅਸੀਂ ਖੂਹ 'ਚੋਂ ਪਾਣੀ ਕੱਢਣ ਦਾ ਸਿਸਟਮ ਬਣਾ ਸਕਦੇ ਹਾਂ